ਹੈਲੋ ਹਾਂਜੀ ਦੱਸੋ ਮੈਂ ਅ ਅਰੁਣ ਕੁਮਾਰ ਬੋਲਦਾ ਕ ਕਿਹੜੀ ਕਲਾਸ ਵਿੱਚ ਕਰਾਉਣੀ ਹੈ ਕਿਨਵੀਂ 'ਚ ਕਰਾਉਣੀ ਏਟਥ ਕਲਾਸ ਵਿੱਚ ਕਰਾਉਣੀ ਹੈ ਅਤੇ ਤੁਹਾਡਾ ਪੋਤਾ ਹੈ ਤੁਹਾਡਾ ਹਾਂਜੀ ਇੱਥੇ ਹੀ ਫਾਜ਼ਿਲਕਾ ਵਿੱਚ ਅੱਠ ਨੌ ਸਕੂਲ ਹਨ ਅੱਛੇ ਸਕੂਲ ਜਿਹੜੇ ਹਾਈ ਸਕੂਲ ਨੇ ਉਹਨਾਂ 'ਚੋਂ ਮਿਡਲ ਸਕੂਲ ਦੀ ਵੀ ਹੈ ਸਾਰਾ ਕੰਮ ਉੱਥੇ ਅਤੇ ਉਹਨਾਂ 'ਚੋ ਸਰਵ ਉੱਚ ਅਧਿਕਾਰੀ ਹੈ ਹੈਰੀਟੇਜ ਸਕੂਲ ਇੱਕ ਹਾਂਜੀ ਆਤਮ ਵਾਲਾ ਸਕੂਲ ਹੈ ਉਹ ਵੀ ਵ ਵਧੀਆ ਹੈ ਉੱਥੋਂ ਦੀ ਉਹ ਪੜ੍ਹਾਈ ਚੰਗੀ ਹੈ ਅਤੇ ਹੋਰ ਇੱਕ ਕ ਕੋਨਵੈਂਟ ਸਕੂਲ ਵੀ ਹੈ ਜਿਹੜਾ ਕਿ ਉਹ ਅੰਗਰੇਜ਼ੀ ਵਾਲੇ ਨੇ ਅਤੇ ਅ ਆਰਮੀ ਸਕੂਲ ਵੀ ਹੈਗਾ ਜੀ ਹਾਂ ਮੇਰਾ ਪੋਤਾ ਆਰਮੀ ਸਕੂਲ 'ਚ ਹੀ ਪੜ੍ਹਦਾ ਅਤੇ ਅੱਠਵੀਂ ਦਾ ਹੀ ਵਿਦਿਆਰਥੀ ਹੈ ਉਹ ਵੀ ਅਤੇ ਮੈਂ ਉਹਨਾਂ ਦੇ ਟੀਚਰਾਂ ਨੂੰ ਜਾਣਦਾ ਪ੍ਰਿੰਸੀਪਲ ਨੂੰ ਵੀ ਜਾਣਦਾ ਪ੍ਰਿੰਸੀਪਲ ਵੀ ਅੱਛੇ ਸੁਭਾਅ ਦੇ ਹਨ ਅਤੇ ਸਾਰੇ ਉਹਨਾਂ ਦੇ ਟੀਚਰ ਵੀ ਵ ਵਧੀਆ ਮਿਹਨਤੀ ਹਨ ਅਤੇ ਉੱਥੋਂ ਦੀ ਪੜ੍ਹਾਈ ਅੱਛੀ ਹੈ ਵੀ ਵੀ ਆਰਮੀ ਸਕੂਲ ਦੀ ਉੱਥੇ ਡਿਸਿਪਲਨ ਵੀ ਚੰਗਾ ਹੈ ਉੱਥੇ ਕੋਈ ਇਹੋ ਜਿਹੀ ਗੱਲ ਨਹੀਂ ਅ ਆਪਣਾ ਬੱਚਾ ਸੇਫ ਹੈ ਉੱਥੇ ਅਤੇ ਬਸ ਵੀ ਜਾਣ ਦੀ ਉੱਥੇ ਸਹੂਲਤ ਹੈਗੀ ਹੈ ਅਤੇ ਆਟੋ ਦੀ ਵੀ ਹੈਗੀ ਹੈ ਸਾਡਾ ਹਾਂਜੀ ਹਾਂ ਸਾਡਾ ਬੱਚਾ ਤਾਂ ਬੱਸ 'ਤੇ ਜਾਂਦਾ ਹੈ ਬੱਸ ਸੇਫ ਹੈ ਹਾਂਜੀ ਹਾਂ ਟਾਈਮ ਨਾਲ ਹੀ ਲੈ ਆਉਂਦੀ ਬੱਸ ਬੱਸ ਦੇ ਵਿੱਚ ਇਹ ਹੈ ਵੀ ਉੱਥੋਂ ਬ ਬਾਰਿਸ਼ 'ਚ ਠੰਢ 'ਚ ਬਚਤ ਰਹਿੰਦੀ ਹੈ ਬੱਸ 'ਚ ਆਉਣ ਦੀ ਅਤੇ ਅ ਆਟੋ ਦੇ ਆਟੋ ਸੇਫ ਨਹੀਂ ਹੈਗਾ ਹਾਂਜੀ ਅਤੇ ਅੱਛਾ ਸਕੂਲ ਮੈਂ ਮੈਂ ਤਾਂ ਤੁਹਾਨੂੰ ਹਾਂਜੀ ਹਾਂ ਜੀ ਹਾਂ ਹਾਂ ਅਤੇ ਓ ਉਹਨਾ ਦੇ ਮੈਥ ਵਾਲੇ ਜਿਹੜੇ ਟੀਚਰ ਆ ਨਾ ਉਹ ਬੜਾ ਅੱਛਾ ਮੈਥ ਪੜ੍ਹਾਉਂਦੇ ਹਨ ਅਤੇ ਅੰਗਰੇਜ਼ੀ ਵਾਲੇ ਵੀ ਅੱਛੀ ਮੈਡਮ ਹੈ ਉਹਨਾਂ ਦੀ ਹੋਰ ਵੀ ਹਿੰਦੀ ਵਾਲੀ ਹੈ ਸੰਸਕ੍ਰਿਤ ਵਾਲੇ ਸਾਰੇ ਹੀ ਉੱਥੇ ਸਬਜੈਕਟ ਹਨ ਜ ਜਿਹੜਾ ਵੀ ਸਬਜੈਕਟ ਬੱਚਾ ਆਪਣਾ ਲੈਣਾ ਚਾਹੇ ਮਿਲ ਜਾਏਗਾ ਕੋਈ ਐਸੀ ਗੱਲ ਨਹੀਂ ਅੱਛਾ ਸਕੂਲ ਹੈ ਅਤੇ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਿਆਂਗਾ ਜੇ ਆਰਮੀ ਸਕੂਲ ਵਿੱਚ ਹੀ ਉਹਨੂੰ ਐਡਮਿਸ਼ਨ ਦਵਾਓ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਕੁਝ ਠੀਕ ਹੈ ਜੀ ਉੱਥੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਸ ਮਿਹ ਰਬਾਨੀ ਜੀ ਠੀਕ ਹੈ ਜੀ